ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਰਾਮ ਕੈਟਰਿੰਗ ਤੋਂ ਬੋਲ ਰਹੇ ਹੋ ਜੀ ਮੈਂ ਹਰਪ੍ਰੀਤ ਕੌਰ ਬੋਲਦੀ ਹਾਂ ਹਾਂਜੀ ਮੈਂ ਮੈਂ ਪਿੰਡ ਮਾਲਣ ਝੱਲੀਆਂ ਤੋਂ ਬੋਲ ਰਹੀ ਹਾਂ ਮੈਡਮ ਹਾਂਜੀ ਮੈਮ ਹਾਂਜੀ ਮੈਮ ਮੇਰੇ ਨਾ ਹਫ਼ਤੇ ਵਿਆਹ ਹੈ ਹਾਂਜੀ ਮੈਂ ਸਾਰਾ ਅਰੈਂਜਮੈਂਟ ਤੁਹਾਡੇ ਤੋਂ ਹੀ ਕਰਵਾਉਣਾ ਚਾਹੁਦੀ ਹਾਂ ਹਾਂਜੀ ਮੈਮ ਪ੍ਰੋਗਰਾਮ ਅਠਾਰਾਂ ਜੁਲਾਈ ਦਾ ਹੈ ਹਾਂਜੀ ਮੈਮ ਦਿਨ ਦਾ ਹੀ ਪ੍ਰੋਗਰਾਮ ਹੈ ਹਾਂਜੀ ਹਾਂਜੀ ਮੈਡਮ ਰਿਸ਼ਤੇਦਾਰ ਤਾਂ ਡੇਢ ਸੌ ਹੋ ਜਾਣੇ ਹੈ ਜੀ ਅੱਛਾ ਮੈਮ ਖਾਣੇ ਵਿੱਚ ਕੀ ਕੀ ਆਈਟਮ ਮਿਲਣਗੇ ਸਾਨੂੰ ਹਾਂਜੀ ਹਾਂਜੀ ਅੱਛਾ ਅੱਛਾ ਜੀ ਹਾਂਜੀ ਲੰਚ ਵਿੱਚ ਹਾਂਜੀ ਹਾਂਜੀ ਹਾਂਜੀ ਠੀਕ ਹੈ ਅੱਛਾ ਠੀਕ ਹੈ ਠੀਕ ਹੈ ਮੈਮ ਫਿਰ ਮੈਮ ਇੱਕ ਪਲੇਟ ਦਾ ਕੀ ਰੇਟ ਹੋਵੇਗਾ ਅੱਛਾ ਮੈਡਮ ਇਹ ਫਿਰ ਤੁਸੀਂ ਰੇਟ ਘੱਟ ਕਰ ਲਉਂਗੇ ਥੋੜ੍ਹਾ ਹਾਂਜੀ ਹਾਂਜੀ ਠੀਕ ਹੈ ਮੈਮ ਹਾਂਜੀ ਹਾਂਜੀ ਮੈਮ ਸਾਡੇ ਘਰ ਘਰ ਦੇ ਨਾਲ ਹੀ ਗਰਾਊਂਡ ਹੈ ਤੁਸੀਂ ਆ ਜਾਉ ਅਤੇ ਮੈਂ ਤੁਹਾਨੂੰ ਜਗ੍ਹਾ ਦਿਖਾ ਦੇਵਾਂਗੀ ਹਾਂਜੀ ਨਹੀਂ ਮੈਮ ਫੇਰ ਤਾਂ ਵਧੀਆ ਜੀ ਮੈਮ ਸਾਰਾ ਕੁਝ ਇੱਕ ਜਗ੍ਹਾ 'ਤੇ ਹੀ ਹੋ ਜਾਵੇਗਾ ਹਾਂਜੀ ਡੈਕੋਰੇਸ਼ਨ ਦਾ ਵੀ ਤੁਸੀਂ ਉਹ ਕਰ ਦਿਓ ਮੈਮ ਇਹ ਦਾ ਚਾਰਜ ਅਲੱਗ ਤੋਂ ਕਿੰਨਾ ਕੁ ਹੋਵੇਗਾ ਹਾਂਜੀ ਅੱਛਾ ਜੀ ਇੱਕ ਨਾ ਮੈਮ ਜਿਹੜੀ ਡੇੈਕੋਰੇਸ਼ਨ ਹੈ ਨਾ ਇਹ ਬਹੁਤ ਜ਼ਿਆਦਾ ਵਧੀਆ ਕਰਨੀ ਹੈ ਜਿਹੜੀ ਸੋਹਣੀ ਲੱਗੇ ਤਾਂ ਦਰਵਾਜ਼ਿਆਂ 'ਤੇ ਖਿੜਕੀਆਂ 'ਤੇ ਚੁੰਨੀਆਂ ਲਗਾਉਣੀਆਂ ਹੈ ਰੀਬਨ ਲਗਾਉਣੇ ਹੈ ਹਾਂਜੀ ਚਲੋ ਠੀਕ ਹੈ ਮੈਮ ਮੈਂ ਫਿਰ ਤੁਹਾਡੇ ਸ਼ੌਪ 'ਤੇ ਆਉਂਦੀ ਹਾਂ ਫਿਰ ਬਹਿ ਕੇ ਗੱਲ ਕਰਦੇ ਹਾਂ ਜੀ ਠੀਕ ਹੈ ਓ ਕੇ ਜੀ ਹਾਂਜੀ ਮੇਰਾ ਹੀ ਨੰਬਰ ਹੈ ਜੀ ਠੀਕ ਹੈ ਮੈਮ ਹਾਂਜੀ ਠੀਕ ਹੈ ਮੈਮ ਓਕੇ ਓਕੇ ਜੀ ਠੀਕ ਹੈ ਮੈਮ ਜੀ ਓਕੇ ਬਾਏ ਥੈਂਕ ਯੂ ਜੀ